ਚੌਵੀ ਬਾਰਾਂ ਉੱਨੀ ਸੌ ਪੰਝੱਤਰ ਬਾਰਾਂ ਬਾਰਾਂ ਦੋ ਹਜ਼ਾਰ ਛੇ ਵੀਹ ਦਸ ਉੱਨੀ ਸੌ ਪੰਤਾਲੀ ਤੇਈ ਛੇ ਉੱਨੀ ਸੌ ਸਤੱਤਰ ਦੋ ਤਿੰਨ ਦੋ ਹਜ਼ਾਰ ਚੌਦਾਂ